ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਹੀ ਮਹੱਤਤਾ ਹੈ ਸਮੇਂ ਦੇ ਨਾਲ ਇਹ ਪੰਜਾਬ ਦੇ ਹਰ ਤਿਉਹਾਰਾਂ ਦਾ

ਅਸੀਂ ਆਮ ਤੌਰ 'ਤੇ ਇਹ ਵੀ ਵੇਖਦੇ ਹਾਂ ਕਿ ਸਕੂਲਾਂ ਕਾਲਜਾਂ ਵਿੱਚ ਜਾਂ ਕੋਈ ਫੰਕਸ਼ਨ ਜਾਂ ਤਿਉਹਾਰ ਦੇ ਮੌਕੇ ਭੰਗੜੇ ਵਿੱਚ ਵਿਦਿਆਰਥੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਭੰਗੜਾ ਪਾਉਂਦੇ ਹਨ ਹੌਲੀ ਹੌਲੀ ਇਹ ਸਾਡੇ ਪੰਜਾਬ ਵਿੱਚ ਇੱਕ ਲੋਕ ਨਾਚ ਬਣ ਚੁੱਕਿਆ ਹੈ ਭੰਗੜਾ ਵੀ ਵੱਖ ਵੱਖ ਤਰੀਕੇ ਦਾ ਹੁੰਦਾ ਹੈ ਜਿਵੇਂ ਕਿ ਮਲਵਈ ਭੰਗੜਾ ਜਿਵੇਂ ਆਮ ਤੌਰ 'ਤੇ ਅਸੀਂ ਦੇਖਦੇ ਹੀ ਹਾਂ ਕਿ ਸਾਡੇ ਪੰਜਾਬ ਵਿੱਚ ਵੱਖ ਵੱਖ ਪ੍ਰਕਾਰ ਦੇ ਭੰਗੜੇ ਹਨ ਜਿਵੇਂ ਅਸੀਂ ਇਹ ਵੀ ਦੇਖਦੇ ਹਾਂ ਕਿ ਇਹ ਹੁਣ ਮੈਰਿਜ ਆਪਣੇ ਵਿਆਹ ਦੀ ਮੌਕੇ ਵੀ ਭੰਗੜਾ ਪਾਇਆ ਜਾਂਦਾ ਜਾਂ ਅਗੇਜਮੈਂਟ ਦੇ ਮੌਕੇ ਜਾਂ ਕਿਸੇ ਹੋਰ ਖੁਸ਼ੀ ਦੇ ਮੌਕੇ ਵੀ ਭੰਗੜਾ ਪਾਇਆ ਜਾਂਦਾ ਹੈ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਇਹ ਸਕੂਲਾਂ ਕਾਲਜਾਂ ਵਿੱਚ ਤਿਉਹਾਰਾਂ ਜਾਂ ਫੰਕਸ਼ਨਾਂ ਦੇ ਮੌਕੇ ਪਾਇਆ ਜਾਂਦਾ ਹੈ ਪੰਜਾਬੀ ਨੌਜਵਾਨ ਇਸ ਨੂੰ ਬਹੁਤ ਹੀ ਪਸੰਦ ਕਰਦੇ ਹਨ ਅਤੇ ਇਹ ਸਾਡੀ ਪੰਜਾਬੀਆਂ ਦੀ ਸ਼ਾਨ ਹੈ ਭੰਗੜਾ ਸਾਡੇ ਪੰਜਾਬ ਵਿੱਚ ਬਹੁਤ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਪਰ ਹੁਣ ਇਹ ਸਾਡੇ ਪੰਜਾਬ ਦਾ ਇੱਕ ਮੁੱਖ ਹਿੱਸਾ ਬਣ ਚੁੱਕਿਆ ਅਤੇ ਲੋਕ ਨਾਚ ਬਣ ਚੁੱਕਿਆ ਹੈ ਇਸ ਨੂੰ ਹਰ ਖੁਸ਼ੀ ਦੇ ਮੌਕੇ ਜਾਂ ਤਿਉਹਾਰ ਦੇ ਮੌਕੇ ਭੰਗੜਾ ਪਾਇਆ ਜਾਂਦਾ ਹੈ